ਪੰਜਾਬੀ ਸਿੱਖਿਆ ਦੇ ਗੁਣਵੱਤਾ ਵਿੱਚ ਯੋਗਦਾਨ ਪਾਉਣ ਵਾਲੇ ਮੋਖਾਰਕ ਇਹ ਹਨ ਕਿ ਲਰਨਿੰਗ ਟਾਈਮ ਸਕੋਲਰਸ਼ਿਪ ਹੈ ਜਿਸ ਤਰ੍ਹਾਂ ਜਿਹੜੇ ਸਕੂਲ ਦੇ ਉਹਨਾਂ ਨੇ ਸਕੋਲਰਸ਼ਿਪ ਰੱਖੀ ਹੁੰਦੀ ਹੈ ਕਿ ਜਿਹੜੇ ਬੱਚੇ ਪੜ੍ਹਨ 'ਚ ਬਹੁਤ ਵਧੀਆ ਹੈ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਕਿ ਉਹ ਜਿਸ ਤਰ੍ਹਾਂ ਪੜ੍ਹਦੇ ਪਏ ਆ ਉਹਨਾਂ ਨੂੰ ਹੋਰ ਵੱਧ ਕੇ ਅੱਗੇ ਵਧਣ ਅਤੇ ਹੋਰ ਪੜ੍ਹਨ ਸਕੋਲਰਸ਼ਿਪ ਮਿਲਣ ਨਾਲ ਮੇਨਲੀ ਜੋ ਕਿ ਗਰੀਬ ਘਰ ਦੇ ਬੱਚੇ ਵੀ ਚੰਗੇ ਸਕੂਲਾਂ ਚ ਵਧੀਆ ਪੜ੍ਹਾਈ ਲੈ ਸਕਦੇ ਹਨ ਤੇ ਉਹ ਜੇ ਉਹਨਾਂ ਦਾ ਪੜਨ ਵਿੱਚ ਇੰਟਰਸਟ ਹੈ ਉਹ ਕਾਫੀ ਅੱਗੇ ਨਿਕਲ ਸਕਦੇ ਆ ਮੇਨਲੀ ਜੋ ਸਕੋਲਰਸ਼ਿਪ ਹੈ ਉਹ ਸਿਰਫ ਪੜ੍ਹਾਈ ਦੇ ਉੱਪਰ ਨਹੀਂ ਮਿਲਦੀ ਅੱਜ ਕੱਲ੍ਹ ਜਿਹੜੀ ਜੇ ਬੱਚਾ ਸਪੋਰਟਸ ਕੋਟਾ ਹੋ ਗਿਆ ਜੇ ਖੇਡਣ ਵਿੱਚ ਬਹੁਤ ਵਧੀਆ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਕਿ ਖੇਡਣ ਦੇ ਨਾਲ ਨਾਲ ਉਹ ਪੜ੍ਹਾਈ 'ਚ ਵੀ ਵਧੀਆ ਨਿਕਲਣ ਅਤੇ ਅੱਗੇ ਨਿਕਲਣ ਅਤੇ ਆਪਣੇ ਰਾਜ ਵਿੱਚ ਉਹਨਾਂ ਦਾ ਜੇ ਉਹ ਵਧੀਆ ਪੜ੍ਹਨਗੇ ਵਧੀਆ ਖੇਡਣਗੇ ਅਤੇ ਵਧੀਆ ਯੋਗਦਾਨ ਦੇਣਗੇ ਆਪਣੇ ਰਾਜ ਨੂੰ ਅੱਗੇ ਵਧਣ ਵਾਸਤੇ ਜੇ ਸਾਡੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਸਕੋਲਰਸ਼ਿਪ ਦਿੱਤੀ ਜਾਏਗੀ ਅਤੇ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕਰਦਾ ਹੈ ਅੱਗੇ ਵਧਣ ਵਿੱਚ ਜ਼ਿੰਦਗੀ ਦੇ ਅੱਗੇ ਆਪਨੇ ਰਾਜ ਨੂੰ ਅੱਗੇ ਲਿਜਾਉਣ ਵਿੱਚ ਜੇ ਜਿਸ ਤਰ੍ਹਾਂ ਸਕੋਲਰਸ਼ਿਪ ਮਿਲਦੀ ਹੈ ਤੋਂ ਖੇਡਾਂ ਵਿੱਚ ਬਹੁਤ ਅੱਗੇ ਜਾਂਦੇ ਅਤੇ ਆਪਣੇ ਰਾਜ ਦਾ ਨਾਂ ਕਰਦੇ ਆ ਉਹ ਇੰਟਰਨੈਸ਼ਨਲ ਲੈਵਲ 'ਤੇ ਖੇਡਦੇ ਆ ਵਧੀਆ ਵਧੀਆ ਕੰਟਰੀਜ਼ ਨਾਲ ਖੇਡਦੇ ਅਤੇ ਸਕੋਲਰਸ਼ਿਪ ਅਤੇ ਆ ਵਗੈਰਾ ਮਿਲਣ ਨਾਲੋਂ ਇਹ ਬਹੁਤ ਜ਼ਿਆਦਾ ਯੋਗਦਾਨ ਦਿੰਦੇ ਹਨ ਪੰਜਾਬ ਦੀ ਸਿੱਖਿਆ ਦੇ ਵਿੱਚ ਗੁਣ ਗੁਣਨਾ ਗੁਣਵੱਤਾ ਵਿਚ ਯੋਗਦਾਨ ਬਹੁਤ ਜ਼ਿਆਦਾ ਕਰਦੇ ਹਨ